ਗੁਡ ਮੋਰਨਿੰਗ ਜੀ ਸਰ

ਓਕੇ ਠੀਕ ਹੈ ਸਰ ਕੀ ਜਾਣਨਾ ਚਾਹੁੰਦੇ ਹੋ ਸਰ ਤੁਸੀਂ ਜੀ ਸਰ ਜਿਵੇਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਗੁਰਦਾਸਪੁਰ ਏਰੀਏ ਵਿੱਚ ਹੁਣ ਕਾਫੀ ਜੋਬਸ ਨਿਕਲ ਰਹੀਆਂ ਏ ਨੇ ਜਿਵੇਂ ਕਿ ਥੋੜ ਜਿਵੇਂ ਕਿ ਪ੍ਰਾਈਵੇਟ ਸੈਕਟਰ 'ਚ ਕਾਫੀ ਜੋਬਸ ਨੇ ਅਤੇ ਤੁਸੀਂ ਮੈਨੂੰ ਆਪਣਾ ਰਿਜ਼ੀਊਮੇ ਵਗੈਰਾ ਸੈਂਡ ਕਰ ਦਿਓਗੇ ਨਹੀਂ ਗੋਰਮੈਂਟ ਰਿਲੇਟਡ ਵੀ ਕਾਫੀ ਨਿਕਲਦੀਆਂ ਨੇ ਉਹਦੇ ਮਤਲਬ ਤੁਹਾਡੀ ਕੁਆਲੀਫਿਕੇਸ਼ਨ ਬੇਸਿਸ 'ਤੇ ਤੁਹਾਨੂੰ ਜੋ ਤੁਹਾਡੇ ਲੈਵਲ ਅਪਲਾਈ ਹੋਏਗੀ ਉਹ ਅਸੀਂ ਕਰ ਦਿਆਂਗੇ ਹਾਂਜੀ ਇਸ ਨੰਬਰ 'ਤੇ ਕਰ ਦਿਓ ਸਰ ਓਕੇ ਸਰ ਥੈਂਕਯੂ ਸਰ